ਮੈਂ ਜੇ ਕੇ ਰੈਸਟਰੋਰੈਂਟ ਅਤੇ ਉਹਨਾਂ ਦੇ ਡਿਲੀਵਰੀਮੈਨ ਦੀ ਸੇਵਾ ਨਾਲ਼ ਬਹੁਤ ਪ੍ਰਸੰਨ ਹਾਂ ਕਿਉਂਕਿ ਮੈਨੂੰ ਪਤਾ ਲੱਗਿਆ ਹੈ ਕਿ ਉਹਨਾਂ ਨੇ ਮੇਰੀ ਮਾਤਾ ਜੀ ਨੂੰ ਅੱਜ ਜਾਨ 'ਤੇ ਖੇਲ ਕੇ ਬਚਾਇਆ ਹੈ